ਓਕਟੋਪਸ ਅਮਰੀਕਨ ਮੈਪਲ ਰੈਡ ਆਰਚ ਸੈਲਡ ਸੈਂਡਵਿਚ ਬਰੈਡ ਸਟਰੀਕ ਫਿਸ਼ ਸ਼੍ਰੇਮ ਰਾਈਸ ਪੀਜ਼ਾ ਹੈਮਬਰਗਰ ਐਗਜ ਚੀਜ਼ ਸੋਸਿਜ਼ ਐਪਲ ਜੂਸ ਗਰੇਪ ਜੂਸ ਮਿਲਕ ਕੈਂਡੀ ਕੁਕੀਜ਼ ਪਾਈ ਕੇਕ ਕੱਪ ਕੇਕ ਡੋਨਿਟਸ